ਨਗਰਪਾਲਿਕਾ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਕਾਇਮ ਕੀਤੀ ਜਾਂਦੀ ਹੈ ਪੰਚਾਇਤ ਹੈ ਜਿਹੜੀ ਉਹ ਪਿੰਡ ਦੀ ਸਮੱਸਿਆਵਾਂ ਸੰਬੰਧੀ ਗਠਿਤ ਕੀਤੀ ਜਾਂਦੀ ਹੈ ਮੁੱਖ ਗੱਲਾਂ ਸ਼ਾਮਿਲ ਇਹ ਹਨ ਦੋਨਾਂ ਦਾ ਜਿਹੜਾ ਕੰਮ ਹੈ ਉਹ ਲੋਕ ਭਲਾਈ ਲਈ ਨਿਯੁਕਤ ਕੀਤੀਆਂ ਜਾਂਦੀਆਂ ਹਨ